ਸਤਿ ਸ਼੍ਰੀ ਅਕਾਲ ਜੀ

ਹਾਂਜੀ ਮੈਮ ਤੁਸੀਂ ਕਿਸ ਤਰ੍ਹਾਂ ਦੀ ਨੌਕਰੀ ਦੇਖ ਰਹੇ ਹੋ ਹਾਂਜੀ ਮੈਮ ਤੁਸੀਂ ਦੇਖ ਸਕਦੇ ਹੋ ਸਾਡਾ ਇੱਕ ਆਫਿਸ ਹੈਗਾ ਇੱਥੇ ਕਪੂਰਥਲਾ ਰੋਡ ਕੋਲ ਉੱਥੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਅਕਾਊਂਟੈਂਟ ਵੀ ਹੋ ਗਈ ਜਿੱਦਾਂ ਕੰਪਿਊਟਰ ਦੀ ਹੋ ਗਈ ਅਲੱਗ ਅਲੱਗ ਤਰ੍ਹਾਂ ਦੀ ਦੇਖ ਰਹੇ ਤੁਸੀਂ ਆਫਿਸ ਵਿੱਚ ਕਿਹੋ ਜਿਹੇ ਕੰਮ ਕਰਨਾ ਪਸੰਦ ਕਰੋਗੇ ਮੈਮ ਅੱਛਾ ਜੀ ਤਾਂ ਅਸੀਂ ਇੱਕ ਅਕਾਊਂਟੈਂਟ ਦਾ ਕੰਮ ਹੈਗਾ ਸਾਡੇ ਕੋਲ ਤੁਸੀਂ ਉਹਦੇ ਵਿੱਚ ਵੀ ਦੇਖ ਸਕਦੇ ਹੋ ਜਾਂ ਇੱਕ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਦਾ ਕੋਈ ਕੰਮ ਹੈ ਫੀਲਡ ਵਗੈਰਾ ਦਾ ਉਹ ਸਾਡਾ ਨਾਈਨ ਟੂ ਫਾਈਵ ਦਾ ਰਹਿੰਦਾ ਮੈਡਮ ਟਾਈਮ ਮੈਮ ਤੁਸੀਂ ਐਚ ਆਰ ਦੀ ਨੌਕਰੀ ਲਈ ਜਾਣਾ ਪਸੰਦ ਕਰੋਗੇ ਨਹੀਂ ਨਹੀਂ ਮੈਮ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ ਸਾਰਾ ਕੁਝ ਔਨਲਾਈਨ ਹੀ ਹੁੰਦਾ ਤੁਸੀਂ ਘਰ ਬੈਠ ਕੇ ਵੀ ਤੁਸੀਂ ਤੁਸੀਂ ਵਰਕ ਫਰੋਮ ਹੋਣ ਦੀ ਵੀ ਆਪਸ਼ਨ ਲੈ ਸਕਦੇ ਹੋ ਉਹ ਤੁਸੀਂ ਦੇਖੋ ਤੁਸੀਂ ਆਫਿਸ ਆ ਕੇ ਅੱਛਾ ਅੱਛਾ ਜੀ ਅਤੇ ਮੈਮ ਸਾਡੇ ਕੋਲ ਇੱਕ ਹੈਗੀ ਆ ਐਚ ਆਰ ਦੀ ਇੱਕ ਵੈਕੈਂਸੀ ਹੈਗੀ ਹੈ ਸਾਡੇ ਕੋਲ ਨਾਈਨ ਟੂ ਫਾਈਵ ਦਾ ਕੰਮ ਹੁੰਦਾ ਉਥੇ ਤੁਸੀਂ ਬਸ ਲੋਕਾਂ ਨੂੰ ਅੱਗੇ ਲੈਣਾ ਤੁਸੀਂ ਇਕ ਚੇਨ ਸਰਕਲ ਟਾਈਪ ਬਣਾਉਣਾ ਨਹੀਂ ਮੈਮ ਸਰਕਾਰੀ ਨੌਕਰੀ ਲਈ ਤਾਂ ਅਸੀਂ ਮਦਦ ਨਹੀਂ ਕਰ ਸਕਦੇ ਉਹਦੇ ਲਈ ਤਾਂ ਤੁਹਾਨੂੰ ਆਪ ਹਾਂਜੀ ਤਿਆਰੀ ਵਾਸਤੇ ਸਾਡੇ ਕੋਲ ਬਥੇਰੇ ਹੈਗੇ ਆ ਸੈਂਟਰ ਉਹ ਤੁਹਾਨੂੰ ਮੈਂ ਅੱਗੇ ਰੈਫਰੈਂਸ ਦੇ ਸਕਦੀ ਹਾਂ ਪਰ ਅਸੀਂ ਤਾਂ ਸਿਰਫ ਨੌਕਰੀਆਂ ਵਾਸਤੇ ਮੈਡਮ ਆਪਾਂ ਅਪਲਾਈ ਕਰਾਉਂਦੇ ਆ ਨਹੀਂ ਨਹੀਂ ਪੰਜਾਹ ਸਾਲ ਤੋਂ ਘੱਟ ਨਹੀਂ ਪੰਜਾਹ ਸਾਲ ਤੋਂ ਘੱਟ ਹੋਣੇ ਚਾਹੀਦੇ ਹੋ ਤੁਸੀਂ ਅਤੇ ਅਠਾਰਾਂ ਤੋਂ ਉੱਪਰ ਹੋਣੇ ਚਾਹੀਦੇ ਹੋ ਤਾਂ ਹੋਰ ਕੁ ਨਹੀਂ ਅਤੇ ਤੁਹਾਡੀ ਪੜ੍ਹਾਈ ਕਿਸ ਵਿੱਚ ਕੀਤੀ ਹੈ ਤੁਸੀਂ ਅੱਛਾ ਜੀ ਤੇ ਤੁਹਾਡਾ ਕੋਈ ਸਪੈਸੀਫੀਕੇਸ਼ਨ ਹੈਗੀ ਆ ਕਾਹਦੇ ਵਿੱਚ ਤੁਸੀਂ ਕੀਤੀ ਆ ਅੱਛਾ ਜੀ ਠੀਕ ਹੈ ਮੈਂ ਤੁਹਾਨੂੰ ਤੁਹਾਡੇ ਇਸੀ ਤੁਹਾਡੇ ਕੋਲ ਵਟਸਐਪ ਇਸੀ ਨੰਬਰ 'ਤੇ ਹੈਗਾ ਮੈਂ ਤੁਹਾਨੂੰ ਨਾ ਠੀਕ ਹੈ ਜੀ ਮੈਂ ਤੁਹਾਨੂੰ ਤਿੰਨ ਚਾਰ ਤਰ੍ਹਾਂ ਦੀਆਂ ਭੇਜ ਦੇਵਾਂਗੀ ਤੁਹਾਨੂੰ ਜੋ ਇਹਦੇ ਵਿੱਚ ਸਹੀ ਲੱਗੇ ਠੀਕ ਲੱਗਦਾ ਹੋਵੇ ਤਾਂ ਤੁਸੀਂ ਮੈਨੂੰ ਅੱਗੇ ਦੱਸ ਦਿਓ ਫਿਰ ਉਸ ਤੋਂ ਬਾਅਦ ਦਾ ਅੱਗੇ ਦਾ ਕੰਮ ਅਸੀਂ ਦੇਖ ਲਵਾਂਗੇ